ਚੈਟ ਜੀ ਪੀ ਟੀ ਇੱਕ ਨਵੀਂ ਤਕਨੀਕ ਹੈ ਅਤੇ ਇਹ ਸਾਡੇ ਲਈ ਬਹੁਤ ਹੀ ਜਿਆਦਾ ਮਹੱਤਵਪੂਰਨ ਹੈ ਚੈਟ ਜੀ ਪੀ ਟੀ ਦੇ ਵਿੱਚ ਇੱਕ ਵੈਬਸਾਈਟ ਏਆਈ ਹੁੰਦੀ ਹੈ ਏਆਈ ਦਾ ਮਤਲਬ ਆਰਟੀਫਿਸ਼ਅਲ ਇਟੈਲੀਜੈਸ ਇਹ ਇਹਦੇ ਜਰੀਏ ਅਸੀਂ ਬਹੁਤ ਮਹੱਤਵਪੂਰਨ ਜਾਣਕਾਰੀ ਹਾਸਿਲ ਕਰ ਸਕਦੇ ਹਾਂ ਏ ਆਈ ਨੂੰ ਅਸੀਂ ਕੰਪਿਊਟਰ ਜਾਂ ਮੋਬਾਈਲ ਦੋਨਾਂ ਚੀਜ਼ਾਂ ਤੇ ਚਲਾ ਸਕਦੇ ਹਾਂ ਏ ਆਈ ਦੇ ਵਿੱਚ ਇੱਕ ਬੀਟਾ ਵਰਜ਼ਨ ਹੁੰਦਾ ਹੈ ਜੋ ਕਿ ਬਹੁਤ ਹੀ ਜਿਆਦਾ ਮਹੱਤਵਪੂਰਨ ਹੈ ਏੇ ਆਈ ਸਾਡੇ ਲਈ ਬਹੁਤ ਹੀ ਜਿਆਦਾ ਕੰਮ ਕਰਦੀ ਹੈ ਜੋ ਡਾਟਾ ਅਸੀਂ ਏ ਆਈ ਨੂੰ ਦਿੰਦੇ ਹਾਂ ਏ ਆਈ ਉਸ ਨੂੰ ਠੀਕ ਕਰਕੇ ਸਾਨੂੰ ਦੁਬਾਰਾ ਦਿੰਦੀ ਹੈ ਏ ਆਈ ਦੇ ਜਰੀਏ ਅਸੀਂ ਆਪਣਾ ਟਰੈਵਲ ਦਾ ਪਲਾਨ ਵੀ ਬਣਾ ਸਕਦੇ ਹਾਂ ਮੰਨ ਕੇ ਚੱਲੋ ਅਸੀਂ ਦਿੱਲੀ ਵਿੱਚ ਟੂਰ ਪਲਾਨ ਕਰਨਾ ਹੈ ਤਾਂ ਸਾਨੂੰ ਏ ਆਈ ਦਿੱਲੀ ਦੀਆਂ ਸਾਰੀਆਂ ਟੂਰਿਸਟ ਜਗਾਵਾਂ ਦਾ ਪਤਾ ਦੱਸੇਗੀ ਵੀ ਕਿਹੜੀ ਕਿਹੜੀ ਜਗ੍ਹਾ ਤੇ ਅਸੀਂ ਘੁੰਮ ਸਕਦੇ ਹਾਂ ਬਾਕੀ ਅੱਜ ਦੇ ਟਾਈਮ ਵਿੱਚ ਏ ਆਈ ਵਟਸਅਪ ਤੇ ਫੇਸਬੁਕ ਦੇ ਜਰੀਏ ਬਹੁਤ ਮਦਦਗਾਰ ਹੈ ਫੇਸਬੁੱਕ ਜਾ ਵਟਸਅਪ ਉੱਪਰ ਅਸੀਂ ਜੇਕਰ ਕਿਸੇ ਚੀਜ਼ ਨੂੰ ਲੱਭਣਾ ਹੈ ਤਾਂ ਅਸੀਂ ਸਰਚ ਕਰ ਸਕਦੇ ਹਾਂ ਇਹ ਸਾਨੂੰ ਪੂਰੀ ਸਟੀਕ ਜਾਣਕਾਰੀ ਦਿੰਦਾ ਹੈ ਅਤੇ ਸਾਡੇ ਲਈ ਮਦਦਗਾਰ ਹੈ